ਪੰਜਾਬ ਦੇ ਵਿੱਚ ਅਗਰ ਲੋਕ ਨਾਚ ਦੀ ਗੱਲ ਕਰੀਏ ਤਾਂ ਮਲਵਈ ਗਿੱਧਾ ਗਿੱਧਾ ਭੰਗੜਾ ਸੰਮੀ ਲੁੱਡੀ ਇਹ ਬਹੁਤ ਸਾਰੇ ਜਿਹੜੇ ਲੋਕ ਨਾਚ ਨੇ ਉਹ ਪੁਰਾਣੇ ਸਮੇਂ ਤੋਂ ਹੀ ਪ੍ਰਚਲਿਤ ਹਨ ਲੋਕ ਸ਼ੁਰੂ ਤੋਂ ਹੀ ਪੁਰਾਣੇ ਸਮਿਆਂ ਤੋਂ ਹੀ ਜਿਵੇਂ ਕਿ ਸਾਡੀਆਂ ਦਾਦੀਆਂ ਅਤੇ ਨਾਨੀਆਂ ਸੀ ਇਹ ਸਭ ਇਕੱਠੀਆਂ ਹੋ ਕੇ ਵਿਆਹ ਤੋਂ ਬਹੁਤ ਸਮੇਂ ਵਿਆਹ ਤੋਂ ਬਹੁਤ ਸਮੇਂ ਪਹਿਲਾਂ ਹੀ ਸ਼ੁਰੂ ਹੋ ਕੇ ਇਕੱਠੀਆਂ ਹੋ ਕੇ ਜਿਹੜੀਆਂ ਲੋਕ ਨਾਚ ਹੈ ਇਹ ਕਰਦੀਆਂ ਹੁੰਦੀਆਂ ਸਨ ਲੋਕ ਗੀਤ ਗਾ ਕੇ ਸੁਹਾਗ ਘੋੜੀਆਂ ਦੇ ਉੱਤੇ ਇਹ ਆਪਣਾ ਗਿੱਧਾ ਅਤੇ ਭੰਗੜਾ ਪਾ ਪਾ ਕੇ ਜਿਹੜੇ ਸ਼ੌਂਕ ਹੈ ਪੂਰੇ ਕੀਤੇ ਜਾਂਦੇ ਸਨ ਪਰ ਅ ਜਿਹੜਾ ਅੱਜ ਕੱਲ੍ਹ ਹੈ ਇਹ ਸਮਾਂ ਬਦਲਣ ਦੇ ਨਾਲ਼ ਜਿਹੜੀ ਸਾਡੇ ਲੋਕ ਨਾਚ ਜਿਹੜੀ ਇਹ ਹੈ ਬਦਲਦੇ ਜਾ ਰਹੇ ਨੇ ਸਾਡਾ ਜਿਹੜਾ ਭੰਗੜਾ ਗਿੱਧਾ ਸਾਡੇ ਮਲਵਈ ਗਿੱਧਾ ਇਹ ਸਾਡੇ ਸੁੰਮੇ ਅ ਸੁ ਸਾਡੇ ਸੰਮੀ ਅਤੇ ਲੁੱਡੀ ਇਹ ਸਭ ਅਲੋਪ ਹੁੰਦੇ ਜਾ ਰਹੇ ਨੇ ਲੋਕ ਵੈਸਟਰਨ ਕਲਚਰ ਅਤੇ ਡਾਂਸ ਜਿੱਦਾਂ ਕਿ ਕੰਨਟੈਪਰਰੀ ਹਿੱਪ ਹੋਪ ਬ੍ਰੇਕ ਡਾਂਸ ਬੋਲੀਵੁੱਡ ਡਾਂਸ ਇਹ ਸਭ ਦੇ ਪਿੱਛੇ ਬਹੁਤ ਜ਼ਿਆਦਾ ਪੈ ਰਹੇ ਹਨ ਪਰ ਜਿਵੇਂ ਜਿਵੇਂ ਅੱਗੇ ਅੱਗੇ ਸ ਸਮਾਂ ਵੱਧ ਰਿਹਾ ਹੈ ਜਿਹੜੇ ਸਾਡੇ ਬੱਚੇ ਨੇ ਉਹ ਆਪਣਾ ਜਿਹੜਾ ਪੰਜਾਬੀ ਵਿਰਸਾ ਹੈ ਪੰਜਾਬੀ ਲੋਕ ਨਾਚ ਹੈ ਉਸ ਨੂੰ ਪਿੱਛੇ ਛੱਡਦੇ ਜਾ ਰਹੇ ਨੇ ਪਹਿਲਾਂ ਜਿਹੜੀਆਂ ਮਾਤਾਵਾਂ ਹੁੰਦੀਆਂ ਸੀ ਉਹ ਇਕੱਠੀਆਂ ਹੋ ਕੇ ਲੋਕ ਨਾਚ ਬਹੁਤ ਚੰਗੇ ਤਰੀਕੇ ਨਾਲ਼ ਗਿੱਧਾ ਇਹ ਬਹੁਤ ਚੰਗੇ ਤਰੀਕੇ ਦੇ ਨਾਲ਼ ਪਾ ਲੈਂਦੀਆਂ ਸਨ ਪਰ ਜਿਹੜੀਆਂ ਅੱਜ ਕੱਲ੍ਹ ਜੇ ਬੱਚੇ ਨੇ ਕਿਸੇ ਨੂੰ ਵੀ ਕਹਿ ਦਿਉ ਕਿ ਆ ਕੇ ਨੱਚ ਲੈ ਸਾਡੇ ਨਾਲ਼ ਤਾਂ ਉਹ ਬਹੁਤ ਹੀ ਸੰਕੋਚ ਕਰਦੇ ਨੇ ਅਤੇ ਜਿਹੜੇ ਜਿਹੜਾ ਪੰਜਾਬੀ ਗਿੱਧਾ ਹੈ ਜਾਂ ਪੰਜਾਬੀ ਸੱਭਿਆਚਾਰ ਉਹ ਮਾਤਾਵਾਂ ਆਪਣੀਆਂ ਦਾਦੀਆਂ ਆਪਣੀਆਂ ਨਾਨੀਆਂ ਦੇ ਨਾਲ਼ ਮਿਲ ਕੇ ਇੱਕ ਨਾਚ ਨਹੀਂ ਕਰ ਸਕਦੇ ਉਹ ਤਾਂ ਜਿਹੜੇ ਹੋਰ ਵੀ ਪਰ ਜਿਹੜਾ ਸਾਡਾ ਹੁਣ ਕਲਚਰ ਹੈ ਉਹ ਵਾਪਿਸ ਹੈ ਜਿਹੜੇ ਸਾਡੇ ਨੌਜਵਾਨ ਸਾਡੇ ਯੰਗ ਪੀੜ੍ਹੀ ਹੈ ਉਹ ਮੁੜ ਕੇ ਆਪਣੇ ਸੱਭਿਆਚਾਰ ਵੱਲ ਆ ਰਹੇ ਨੇ ਫੌਰ ਇਗਜ਼ਾਮਪਲ ਕਿ ਜਿਵੇਂ ਵਿਆਹਾਂ ਦੇ ਵਿੱਚ ਪਹਿਲਾਂ ਇਹ ਟ੍ਰੈਂਡ ਚੱਲ ਪਿਆ ਸੀ ਵਿੱਚ ਕੁ ਜੇ ਜਿੱਥੇ ਕਿ ਜਿਹੜਾ ਮੁੰਡਾ ਸੀ ਜਾਂ ਕੁੜੀ ਸੀ ਇਹਨਾਂ ਦੀ ਐਂਟਰੀ ਡੀ ਜੇ 'ਤੇ ਗਾਣੇ ਲਗਾ ਕੇ ਬੋਲੀਵੁੱਡ ਦੇ ਗਾਣਿਆ ਦੇ ਉੱਤੇ ਇਹਨਾਂ ਦੀ ਜਿਹੜੀ ਐਂਟਰੀ ਸੀ ਕਰਵਾਈ ਜਾਂਦੀ ਸੀ ਪਰ ਅੱਜ ਕੱਲ੍ਹ ਇਹ ਜਿਹੜਾ ਦੌਰ ਹੈ ਮਲਵਈ ਗਿੱਧੇ ਦਾ ਮੁੜ ਕੇ ਆ ਰਿਹਾ ਹੈ ਹੁਣ ਕੋਈ ਵੀ ਐਂਟਰੀ ਹੁੰਦੀ ਹੈ ਜਾਂ ਘਰ ਦੇ ਵਿੱਚ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਹੈ ਮਲਵਈ ਗਿੱਧਾ ਗਰੁੱਪ ਨੂੰ ਬੁਲਾਇਆ ਜਾਂਦਾ ਹੈ ਜਾਂ ਫਿਰ ਗਿੱਧੇ ਵਾਲੀਆਂ ਜਾਂ ਬੋਲੀ ਪਾਉਣ ਵਾਲੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਬੋਲੀਆਂ ਪਾ ਪਾ ਕੇ ਜਿਹੜਾ ਆਪਣਾ ਲੋਕ ਨਾਚ ਹੈ ਉਹ ਕੀਤਾ ਜਾਂਦਾ ਹੈ ਅਤੇ ਕੁੜੀ ਦੀ ਡੋਲੀ ਦੇ ਵੇਲੇ ਵੀ ਜਦੋਂ ਉੱਠਦੀ ਹੈ ਤਾਂ ਜਿਹੜੇ ਲੋਕ ਜਿਹੜੇ ਮਲਵਈ ਗਿੱਧਾ ਵਾਲੇ ਹੁੰਦੇ ਨੇ ਉਹ ਆਪਣੀ ਆਪਣਾ ਗਿੱਧਾ ਪਾ ਕੇ ਅਤੇ ਉਹ ਜਿਹੜੀਆਂ ਕਿ ਦੁੱਖ ਭਰੀਆਂ ਬੋਲੀਆਂ ਪਾ ਪਾ ਕੇ ਜਿਹੜਾ ਆਪਣਾ ਸੱਭਿਆਚਾਰ ਹੈ ਉਹ ਬਾਹਰ ਕੱਢਦੇ ਨੇ ਜਿਹੜਾ ਕਿ ਸਾਡੀਆਂ ਅੱਖਾਂ ਨੂੰ ਵੀ ਭਾਉਂਦਾ ਹੈ ਜਿਹੜੀਆਂ ਸਾਡਾ ਵਿਰਸਾ ਹੈ ਉਹ ਮੁੜ ਕੇ ਆ ਰਿਹਾ ਹੈ ਜੋ ਕਿ ਬਹੁਤ ਵਧੀਆ ਹੈ ਜਿਹੜੇ ਕਿ ਅੱਜ ਕੱਲ੍ਹ ਦੇ ਜਿਹੜੇ ਪੀਪਣੀ ਬੈਂਡ ਫੌਜੀ ਬੈਂਡ ਡੀ ਜੇ ਇਨ੍ਹਾਂ ਸਭ ਤੋਂ ਜਿਹੜਾ ਸਾਡਾ ਕਲਚਰ ਹੈ ਸਾਡਾ ਵਿਰਸਾ ਹੈ ਉਹ ਬਹੁਤ ਹੀ ਜ਼ਿਆਦਾ ਰਿੱਚ ਹੈ ਅਤੇ ਇਨ੍ਹਾਂ ਸਭ ਤੋਂ ਬਹੁਤ ਜ਼ਿਆਦਾ ਉੱਪਰ ਹੈ ਅਤੇ ਉੱਠਿਆ ਹੋਇਆ ਹੈ